ਜੇਕਰ ਸਾਨੂੰ ਬੈਂਕ ਨਾਲ ਕੋਈ ਵੀ ਸਮੱਸਿਆ ਹੈ ਤਾਂ ਅਸੀਂ ਕਨਜਿਉਂਮਰ ਪਰੋਟੈਕਸ਼ਨ ਐਕਟ ਦੇ ਤਹਿਤ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਾਂ ਬੈਂਕ ਦੇ ਸਟਾਫ ਨਾਲ ਮੇਰਾ ਤਜ਼ਰਬਾ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਮੈਨੂੰ ਬੈਂਕ ਦੇ ਰਿਗਾਰਡਿੰਗ ਸਾਰੀ ਇਨਫ਼ਰਮੇਸ਼ਨ ਆ ਹੈ ਨਾ ਸਾਰੀ ਜਾਣਕਾਰੀ ਆ ਮੇਰੇ ਕੋਲ ਤਾਂ ਕਰਕੇ ਜਦੋਂ ਵੀ ਮੈਨੂੰ ਕਿਸੇ ਵੀ ਚੀਜ਼ ਦੀ ਜਰੂਰਤ ਹੁੰਦੀ ਹੈ ਅਤੇ ਮਨੇਜਰ ਮੇਰੀ ਵਧੇਰੇ ਸਹਾਇਤਾ ਕਰਦਾ ਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਦੀ ਮੇਰੇ ਕੋਲ ਵਧੇਰੇ ਜਾਣਕਾਰੀ ਹੈ ਅਤੇ ਮੈਨੂੰ ਪਤਾ ਹੈ ਵੀ ਅਗਰ ਜੇਕਰ ਕੋਈ ਬੈਂਕ ਦਾ ਕੋਈ ਵੀ ਹੈ ਨਾ ਕੋਈ ਵੀ ਵਿਅਕਤੀ ਮੇਰੇ ਨਾਲ ਕੋਈ ਵੀ ਇੱਦਾਂ ਦੀ ਹੈ ਨਾ ਗਲਤ ਹਰਕਤ ਕਰਦਾ ਜਾਂ ਕੋਈ ਵੀ ਸਾਨੂੰ ਹੈ ਨਾ ਮਦਦ ਨਹੀਂ ਕਰਦਾ ਅਤੇ ਮੈਨੂੰ ਪਤਾ ਵੀ ਕਿਹੜੇ ਤਹਿਤ ਅਸੀਂ ਜਾ ਕੇ ਕਿਹੜੇ ਐਕਟ ਦੇ ਤਹਿਤ ਜਾ ਕੇ ਅਸੀਂ ਸ਼ਿਕਾਇਤ ਦਰਜ ਕਰਾ ਸਕਦੇ ਹਾਂ